ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੇਖੋ ਜੀ ਸਾਡੀ ਵੋਲਵੋ ਬਸ ਸਰਵਿਸ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਰੀ ਸਿਟੀਜ਼ ਨੂੰ ਕਨੈਕਟ ਕਰ ਰਹੀ ਆ ਮੇਜਰ ਉਹਨਾਂ ਦੇ ਵਿੱਚ ਆ ਜਾਂਦੀ ਹੈ ਅੰਮ੍ਰਿਤਸਰ ਬਰਨਾਲਾ ਆ ਜਾਂਦਾ ਹੈ ਨਾ ਅਤੇ ਜਾਂ ਜਲੰਧਰ ਕਪੂਰਥਲਾ ਹੋ ਗਿਆ ਪਠਾਨਕੋਟ ਹੋ ਗਿਆ ਮੇਜਰ ਮੇਜਰ ਜਿੱਦਾਂ ਰਾਜਪੁਰਾ ਗੋਬਿੰਦਗੜ ਵਗੈਰਾ ਹੈ ਨਾ ਤਰਨਤਾਰਨ ਲਾ ਲਓ ਜਿੱਦਾਂ ਹੈ ਨਾ ਉੱਥੇ ਦਾ ਅੱਡਾ ਦੇਖੋ ਆਪਣਾ ਗੁਰਦੁਆਰਾ ਸਾਹਿਬ ਵੀ ਹੈਗਾ ਹੈ ਨਾ ਅਤੇ ਗੁਰਦਾਸਪੁਰ ਹੋ ਗਿਆ ਫਤਿਹਗੜ੍ਹ ਸਾਹਿਬ ਜਗਰਾਉਂ ਹੋ ਗਿਆ ਅਤੇ ਬੰਗਾ ਸਾਮਾ ਸੁਲਤਾਨਪੁਰ ਲੋਧੀ ਹੋ ਜਾਵੇਗਾ ਅਤੇ ਗੁਰਦਾਸਪੁਰ ਹੋ ਗਿਆ ਨਾ ਹੁਸ਼ਿਆਰਪੁਰ ਹਾਂਜੀ ਹੁਸ਼ਿਆਰਪੁਰ ਵੀ ਹੋ ਜਾਵੇਗੀ ਅਤੇ ਤੁਸੀਂ ਵਿਦ ਫੈਮਲੀ ਆ ਰਹੇ ਹੋ ਜਾਂ ਕਿੱਦਾਂ ਆਫੀਸ਼ਅਲ ਟਰਿਪ ਆ ਤੁਹਾਡੀ ਅੱਛਾ ਜੀ ਠੀਕ ਆ ਜੀ ਅੱਛਾ ਜੀ ਅਤੇ ਕੀ ਐਟੇਡੇਟਿਵ ਡੇਟ ਕੀ ਹੋਵੇਗੀ ਮਤਲਬ ਕਿੱਦਣ ਦਾ ਅਸੀਂ ਤੁਸੀਂ ਚਾਹ ਰਹੇ ਹੋ ਅੱਛਾ ਜੀ ਠੀਕ ਆ ਅਤੇ ਤੁਸੀਂ ਪ੍ਰੋਪਰ ਕਿੰਨੇ ਕੁ ਬੰਦੇ ਹੋਂਗੇ ਹੈ ਨਾ ਮੈਕਸੀਮਮ ਟਵੈਂਟੀ ਫਾਈਵ ਅਤੇ ਤੁਹਾਨੂੰ ਤੁਹਾਡਾ ਖਰਚਾ ਵਗੈਰਾ ਤੁਹਾਡਾ ਕਿੰਨਾ ਕੁ ਆ ਬਜਟ ਇਹ ਤਾਂ ਪਰ ਪਰਸਨ ਡਿਪੈਂਡ ਕਰਦਾ ਦੇਖੋ ਜੇ ਤੁਸੀਂ ਪੰਦਰਾਂ ਸੌ ਰੁਪਇਆ ਵੀ ਲੱਗ ਜਾਂਦਾ ਜੇ ਤੁਸੀਂ ਖਾਣਾ ਪੀਣਾ ਨਾਲ ਐਡ ਕਰਾ ਰਹੇ ਹੋ ਹੈ ਨਾ ਬਫੇ ਵਗੈਰਾ ਮਿਲਦਾ ਤਾਂ ਬਾਈ ਕੁ ਸੌ ਦੇ ਨੇੜੇ ਤੇੜੇ ਪਰ ਪਰਸਨ ਜੇ ਤੁਸੀਂ ਵਿੱਚ ਏ ਸੀ ਵਗੈਰਾ ਇੰਕਲੂਡ ਇੱਦਾਂ ਦੀਆਂ ਐਕਸਟਰਾ ਸਰਵਿਸ ਐਡ ਕਰੋਂਗੇ ਤਾਂ ਪੈਂਤੀ ਸੌ ਪਰ ਪਰਸਨ ਲੱਗ ਜਾਂਦਾ ਏ ਸੀ ਵਗੈਰਾ ਫਿਰ ਉਹ ਥੋੜ੍ਹਾ

ਛੱਬੀ ਸੌ ਤਾਂ ਥੋੜ੍ਹਾ ਜਿਹਾ ਔਖਾ ਹੋ ਜਾਵੇਗਾ ਥੋੜ੍ਹਾ ਜਿਹਾ ਤੁਸੀਂ ਕਰ ਲਓ ਤਾਂ ਸਹੀ ਰਹੂਗਾ ਮਿਨੀਮਮ ਜੇ ਤੁਸੀਂ ਏ ਸੀ ਵਗੈਰਾ ਐਕਸਟਰਾ ਐਕਟੀਵਿਟੀਜ਼ ਇੰਕਲੂਡ ਕਰਾਉਂਗੇ ਤਾਂ ਤੁਹਾਡੀ ਪੱਚੀ ਬੰਦੇ ਹੋ ਹੈ ਨਾ ਅਤੇ ਉਹਦੇ ਹਿਸਾਬ ਨਾਲ ਫਿਰ ਆਪਾਂ ਕਰ ਸਕਦੇ ਹਾਂ ਤਿੰਨ ਕੁ ਦੇ ਨੇੜੇ ਤੇੜੇ ਕਰ ਲੈਂਦੇ ਹਾਂ ਫਿਰ ਹਾਂਜੀ ਹਾਂਜੀ ਉਹ ਸਾਰਾ ਕੁਛ ਮਿਲੇਗਾ ਠੀਕ ਆ ਜੀ ਜਦੋਂ ਮਰਜੀ ਕਾਲ ਕਰਿਓ

ਠੀਕ ਆ ਜੀ